ਛੋਟੇ ਹੁੰਦੇ ਅਸੀਂ ਪਹਿਲੀ ਕਲਾਸ ਤੋਂ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ ਸੀਗਾ ਅਤੇ ਉਹ ਵੀ ਸਾਨੂੰ ਕੀ ਹੈ ਪੰਜਾਬੀ ਪੰਜਾਬੀ ਦੀਆਂ ਕਿਤਾਬਾਂ ਅਸੀਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਅਤੇ ਜਿਹਨਾਂ ਵਿੱਚ ਕਿ ਬੱਚਿਆਂ ਦੀਆਂ ਬਾਲ ਕਥਾਵਾਂ ਦਾ ਕਾਫ਼ੀ ਪੜ੍ਹੀਆਂ ਉਹਨਾਂ ਵਿੱਚ ਮੈਨੂੰ ਬਾਬੇ ਨਾਨਕ ਦੀ ਮਤਲਬ ਪੜ੍ਹਕੇ ਕਥਾ ਬੜਾ ਹੀ ਪ੍ਰਭਾਵਿਤ ਮੈਂ ਹੋਈ ਜਿਸ ਵਿੱਚ ਬਾਬਾ ਜੀ ਨੇ ਹੱਕ ਸੱਚ ਦੀ ਮਤਲਬ ਹੱਕ ਸੱਚ ਬਾਰੇ ਦੱਸਿਆ ਹੈ ਕਿ ਤੁਹਾਡਾ ਤੁਹਾਨੂੰ ਹਮੇੇਸ਼ਾ ਸੱਚ ਹੀ ਬੋਲਣਾ ਚਾਹੀਦਾ ਹੈ ਅਤੇ ਵਹਿਮਾਂ ਭਰਮਾਂ ਵਿੱਚੋਂ ਸਾਨੂੰ ਕੱਢਿਆ ਉਹਨਾਂ ਨੇ ਕਿ ਵਹਿਮ ਭਰਮ ਵੱਲ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ ਉਹਨਾਂ ਨੇ ਕਿ ਮੂਰਤੀ ਨੂੂੰ ਨਹੀਂ ਪੂਜਣਾ ਔਰ ਉਹਨਾਂ ਨੇ ਸਾਨੂੰ ਹੱਕ ਸੱਚ ਦੀ ਲੜਾਈ ਲੜਨ ਲਈ ਸਾਨੂੰ ਪ੍ਰੇਰਿਤ ਕੀਤਾ ਹੈ ਇਸ ਤੋਂ ਇਲਾਵਾ ਬਾਬੇ ਨਾਨਕ ਨੇ ਸ ਬੱਸ ਇੱਕ ਪੂਜਣਯੋਗ ਸਾਨੂੰ ਦੱਸਿਆ ਹੈ ਕਿ ਤੁਸੀਂ ਜਿਹੜੇ ਜਿਹੜੇ ਆਹ ਪਖੰਡ ਹੋ ਗਏ ਹਨ ਇਹਨਾਂ ਵੱਲ ਬਿਲਕੁੱਲ ਵੀ ਧਿਆਨ ਨੀ ਦੇਣਾ ਪਖੰਡਬਾਜ਼ੀ 'ਚੋਂ ਸਾਨੂੰ ਬਾਹਰ ਕੱਢਿਆ ਹੈ ਅਤੇ ਮੈਂ ਬਹੁਤ ਹੀ ਬਾਬਾ ਨਾਨਕ ਤੋਂ ਬਹੁਤ ਪ੍ਰੇਰਿਤ ਹਾਂ ਅਤੇ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਾਬਾ ਨਾਨਕ ਨੂੰ ਹੀ ਮੰਨਦੀ ਹਾਂ ਉਹ ਇੱਕ ਬਹੁਤ ਵੱਡੇ ਆਲੋਚਕ ਵੀ ਹਨ